ਪਸ਼ੂਆਂ ਨਾਲ ਸਾਡਾ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਬਹੁਤ ਵਧੀਆ ਰੁਟੀਨ ਬਣਿਆ ਹੋਇਆ ਹੈ ਅਸੀਂ ਜਦੋਂ ਸਵੇਰੇ ਉੱਠਦੇ ਹਾਂ ਤਾਂ ਸਭ ਤੋਂ ਪਹਿਲਾਂ ਆਪ ਫਰੈਸ਼ ਹੋ ਕੇ ਨਾਲ ਦੀ ਨਾਲ ਸਾਡੇ ਪੰਜ ਪਸ਼ੂ ਰੱਖੇ ਹਨ ਉਹਨਾਂ ਨੂੰ ਸਭ ਤੋਂ ਪਹਿਲਾਂ ਦਾਣਾ ਪਾਈਦਾ ਜੀ ਦਾਣਾ ਪਾ ਕੇ ਪਸ਼ੂਆਂ ਨੂੰ ਚੰਗੀ ਤਰ੍ਹਾਂ ਉਸ ਤੋਂ ਬਾਅਦ ਉਹਨਾਂ ਦਾ ਕੰਮ ਹੋ ਜਾਂਦਾ ਹੈ ਉਹਨਾਂ ਨੂੰ ਨਵਾਉਣਾ ਉਹਨਾਂ ਨੂੰ ਚੰਗੀ ਤਰ੍ਹਾਂ ਨਵਾ ਲਈ ਦਾ ਜੀ ਨਵਾ ਕੇ ਉਹ ਵਧੀਆ ਫੀਲ ਕਰਦੇ ਹਨ ਉਹਨਾਂ ਦਾ ਜੋ ਵੀ ਉਹਨਾਂ 'ਤੇ ਗੰਦਗੀ ਵਗੈਰਾ ਲੱਗੀ ਹੁੰਦੀ ਹੈ ਉਹ ਸਾਫ ਹੋ ਜਾਂਦੀ ਆ ਜਿਸ ਨਾਲ ਪਸ਼ੂ ਵਧੀਆ ਸਿਹਤਮੰਦ ਰਹਿੰਦਾ ਹੈ ਉਹਨਾਂ ਦੇ ਛੋਟੇ ਬੱਚੇ ਵੀ ਹਨ ਉਹਨਾਂ ਨੂੰ ਵੀ ਇਸ ਤਰ੍ਹਾਂ ਹੀ ਟਾਈਮ ਸਿਰ ਦਾਣਾ ਪਾਣੀ ਪਾ ਕੇ ਨਵਾ ਧਵਾ ਕੇ ਰੱਖੀਦਾ ਜੀ ਉਹਨਾਂ ਨਾਲ ਸਾਡਾ ਬਹੁਤ ਵਧੀਆ ਮੋਹ ਪ੍ਰੇਮ ਹੈ ਕਿਉਂਕਿ ਉਹਨਾਂ ਸਿਰੋਂ ਹੀ ਸਾਡੀ ਕਮਾਈ ਦਾ ਸਾਧਨ ਵੀ ਚੱਲਦਾ ਹੈ ਪੰਜ ਪਸ਼ੂਆਂ ਵਿੱਚੋਂ ਚਾਰ ਪਸ਼ੂ ਸਾਡੇ ਦੁੱਧ ਦਿੰਦੇ ਹਨ ਉਹਨਾਂ ਦਾ ਦੁੱਧ ਨਾਲ ਹੀ ਸਾਡਾ ਘਰ ਦਾ ਗੁਜ਼ਾਰਾ ਵੀ ਬਹੁਤ ਵਧੀਆ ਚੱਲਦਾ ਹੈ ਅਤੇ ਜਦੋਂ ਅਸੀਂ ਸਵੇਰੇ ਉਠਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਆਪਣੀ ਆਵਾਜ਼ ਨਾਲ ਵਧੀਆ ਮੋਹ ਲੈਂਦੇ ਹਨ ਪਿਆਰ ਜੋ ਕਿ ਪਸ਼ੂਆਂ ਨਾਲ ਪਿਆਰ ਬਣਿਆ ਹੁੰਦਾ ਹੈ ਉੱਦਾਂ ਹੀ ਪਿਆਰ ਨਾਲ ਜਦੋਂ ਉਹ ਬੋਲਦੇ ਹਨ ਸਾਨੂੰ ਵੀ ਬਹੁਤ ਵਧੀਆ ਫੀਲ ਹੁੰਦਾ ਹੈ ਤਾਂ ਅਸੀਂ ਉਹਨਾਂ ਨੂੰ ਦਾਣਾ ਪਾਣੀ ਵਧੀਆ ਪਿਆਰ ਨਾਲ ਪਾਉਂਦੇ ਹਾਂ ਚੰਗੀ ਕੁਆਲਿਟੀ ਦਾ ਦਾਣਾ ਪਾਉਣਾ ਪੈਂਦਾ ਹੈ ਤਾਂ ਕਿ ਜੋ ਦੁੱਧ ਵਧੀਆ ਦੇ ਸਕਣ ਅਤੇ ਫਿਰ ਇਹਨਾਂ ਨੂੰ ਤੋਰੇ ਫੇਰੇ ਲਈ ਲੈ ਜਾਂਦੇ ਹਾਂ ਤੋਰੇ ਫੇਰੇ ਨਾਲ ਪਸ਼ੂਆਂ ਦੀਆਂ ਲੱਤਾਂ ਵਧੀਆ ਰਹਿੰਦੀਆਂ ਹਨ ਇੱਕ ਥਾਂ ਖੜ੍ਹ ਖੜ੍ਹੇ ਰਹਿਣ ਕਰਕੇ ਇਹ ਥੋੜ੍ਹਾ ਜਿਹਾ ਇਕੱਲਾਪਣ ਮਹਿਸੂਸ ਕਰਦੇ ਹਨ ਤਾਂ ਇਹਨਾਂ ਨੂੰ ਤੋਰਨ ਫਿਰਨ ਲੈ ਕੇ ਜਾਣਾ ਪੈਂਦਾ ਹੈ ਅਤੇ ਇਹਨਾਂ ਦੇ ਦੋ ਜੋ ਵੱਛੇ ਹਨ ਉਹਨਾਂ ਨੂੰ ਵਧੀਆ ਰੱਖੀ ਦਾ ਜੀ ਕਿਉਂਕਿ ਉਹਨਾਂ ਨਾਲ ਅਸੀਂ ਖੇਡਦੇ ਵੀ ਰਹਿੰਦੇ ਹਾਂ ਸਾਡੇ ਦੋ ਬੱਚੇ ਹਨ ਉਹ ਵੀ ਇਹਨਾਂ ਨਾਲ ਖੇਡਦੇ ਰਹਿੰਦੇ ਹਨ